ਡੇਂਗੂ ਬੁਖਾਰ ਅਤੇ ਮੱਛਰਾਂ ਤੋਂ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਡੇਂਗੂ ਬੁਖਾਰ ਹੋਣ ਨਾਲ ਸਾਨੂੰ ਪੀਲੀਆ ਵੀ ਹੋ ਸਕਦਾ ਹੈ ਸਾਡੇ ਲੀਵਰ ਵਿੱਚ ਨੁਕਸ ਪੈ ਸਕਦਾ ਹੈ ਇਸ ਲਈ ਸਾਨੂੰ ਡੇਂਗੂ ਬੁਖਾਰ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਸਾਨੂੰ ਗਰੀਨ ਵੈਜੀਟੇਬਲਸ ਯੂਜ਼ ਕਰਨੀਆਂ ਚਾਹੀਦੀਆਂ ਹਨ ਹਰੀਆਂ ਸਬਜ਼ੀਆਂ ਖਾਣ ਨਾਲ ਅਸੀਂ ਤੰਦਰੁਸਤ ਰਹਾਂਗੇ ਬੁਖਾਰ ਸਾਨੂੰ ਨਹੀਂ ਹੋਵੇਗਾ ਅਤੇ ਨਾ ਹੀ ਸਾਨੂੰ ਡੇਂਗੂ ਹੋਣ ਦਾ ਖ਼ਤਰਾ ਹੈ ਡੇਂਗੂ ਬੁਖਾਰ ਬਹੁਤ ਹੀ ਭਿਆਨਕ ਬੁਖਾਰ ਹੁੰਦਾ ਹੈ ਆਪਣੇ ਬੱਚਿਆਂ ਨੂੰ ਸਾਫ਼ ਬੋਆਇਲ ਕਰਕੇ ਪਾਣੀ ਨੂੰ ਉਬਾਲ ਕੇ ਦੇਣਾ ਚਾਹੀਦਾ ਹੈ ਅੱਜ ਕੱਲ੍ਹ ਪਾਣੀ ਵੀ ਗੰਦਾ ਕਈ ਵਾਰ ਆਉਂਦਾ ਹੈ ਉਸ ਨਾਲ ਕੀ ਬੱਚੇ ਬਿਮਾਰ ਹੋ ਜਾਂਦੇ ਹਨ ਬੱਚਿਆਂ ਨੂੰ ਪੇਟ ਦੀ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ ਸਾਨੂੰ ਬੱਚਿਆਂ ਨੂੰ ਪਾਣੀ ਵੀ ਹਮੇਸ਼ਾ ਉਬਾਲ ਕੇ ਜਾਂ ਫਿਲਟਰ ਪਾਣੀ ਦੇਣਾ ਚਾਹੀਦਾ ਹੈ ਅਗਰ ਅਸੀਂ ਡੇਂਗੂ ਬੁਖਾਰ ਤੋਂ ਬਚਣਾ ਚਾਹੁੰਦੇ ਹਾਂ ਇਸ ਲਈ ਆਪਣਾ ਧਿਆਨ ਰੱਖਣਾ ਚਾਹੀਦਾ ਹੈ